ਪਰੋਡ ਸਾਹਿਤ ਦੇ ਨਾਲ ਨਾਲ ਬਾਲ ਸਾਹਿਤ ਪ੍ਰਤੀ ਵੀ ਬਰਾਬਰ ਸਿਰਜਣਾ ਕਰਨ ਵਾਲੇ ਅਫਖਾਨਿਗਾਰ ਬਲਦੇਵ ਸਿੰਘ ਦਾ ਨਵਾਂ ਬਾਲ ਕਹਾਣੀ ਸੰਗ੍ਰਹਿ ਬੁਲਬੁਲ ਦੇ ਬੱਚੇ ਪ੍ਰਕਾਸ਼ ਵਿੱਚ ਆਇਆ ਹੈ ਇਸ ਕਥਾ ਸੰਕਰਨ ਵਿੱਚ ਕੁੱਲ ਨੌਂ ਕਹਾਣੀਆਂ ਅੰਕਿਤ ਹਨ ਜੋ ਬਾਲਾਂ ਨੂੰ ਆਦਰਸ਼ ਹੱਕ ਸੱਚ ਅਤੇ ਹੋਰ ਉਸਾਰੂ ਆਸ਼ੀਆਂ ਪ੍ਰਤੀ ਦ੍ਰਿੜ ਕਰਵਾਉਂਦੀਆਂ ਹਨ ਅਤੇ ਸਮਾਜ ਦੀਆਂ ਗਲਤ ਕਦਰਾਂ ਕੀਮਤਾਂ ਪ੍ਰਤੀ ਚੇਤਨ ਕਰਦੀਆਂ ਹੋਈਆਂ ਮਾਨਵੇ ਜੀਵਨ ਦਾ ਸਦਾਚਾਰਕ ਪੱਧਰ ਉੱਚਾ ਚੁੱਕਣ ਵਿੱਚ ਯਥਾਯੋਗ ਭੂਮਿਕਾ ਨਿਭਾਉਂਦੀਆਂ ਹਨ ਇਸ ਸੰਗ੍ਰਹਿ ਵਿਚਲੀਆਂ ਜ਼ਿਆਦਾਤਰ ਕਹਾਣੀਆਂ ਜੀਵ ਜੰਤੂਆਂ ਉੱਪਰ ਅਧਾਰਿਤ ਹਨ ਜਦੋਂ ਕਿ ਕੁਝ ਕਹਾਣੀਆਂ ਮਾਨਵੀ ਪਾਤਰਾਂ ਨੂੰ ਆਧਾਰ ਬਣਾਉਂਦੀਆਂ ਹਨ ਬੁਲਬੁਲ ਦੇ ਬੱਚੇ ਕਹਾਣੀ ਸੰਕੇਤ ਕਰਦੀ ਹੈ ਕਿ ਮਾਸੂਮ ਪੰਛੀ ਵੀ ਮਨੁੱਖੀ ਮੋਹ ਦੇ ਤਲਬਗਾਰ ਹੁੰਦੇ ਹਨ ਇੰਝ ਫਸਿਆ ਬਗਿਆੜ ਕਹਾਣੀ ਵਿੱਚ ਸੰਕਟਕਾਲੀਨ ਪਰਿਸਥਿਤੀਆਂ ਦੌਰਾਨ ਲੂੰਬੜ ਆਪਣੇ ਦੋਖੀ ਬਗਿਆੜ ਨੂੰ ਸ਼ੇਰ ਕੋਲ ਫਸਾ ਕੇ ਦੂਰ ਅੰਦੇਸ਼ੀ ਦਾ ਪ੍ਰਮਾਣ ਦਿੰਦਾ ਹੈ ਚਿੜੀ ਦੀ ਹੁਸ਼ਿਆਰੀ ਕਹਾਣੀ ਵਿੱਚ ਇਸ ਆਸ਼ਏ ਨੂੰ ਪ੍ਰਚਾਰਦੀ ਹੈ ਕਿ ਔਖੀ ਘੜੀ ਵਿੱਚ ਯੋਜਨਾ ਬੰਧ ਮਨਸੂਬੇ ਅਤੇ ਸਿਆਣਪ ਨਾਲ ਸੰਕਟਮਈ ਹਾਲਾਤ ਦਾ ਕਿਵੇਂ ਸਾਹਮਣਾ ਕੀਤਾ ਜਾ ਸਕਦਾ ਹੈ ਜੈਸੇ ਕੋ ਤੈਸਾ ਆ ਕੇ ਝੁੱਗਾ ਚੌੜ ਕਰਾਉਣ ਵਾਲਿਆਂ ਨੂੰ ਸਾਵਧਾਨ ਕਰਦੀ ਹੈ ਜਦੋਂ ਕਿ ਮਿੱਠੇ ਸ਼ੱਕਰ ਕੌੜੀ ਸ਼ੱਕਰ ਕਹਾਣੀ ਦੋ ਕੀੜੀਆਂ ਦੇ ਮਾਧਿਅਮ ਦੁਆਰਾ ਭੈੜੇ ਵਿਚਾਰ ਅਤੇ ਭੈੜੀ ਸੋਚ ਦਾ ਤਿਆਗ ਕਰਨ ਦੀ ਪ੍ਰੇਰਨਾ ਦਿੰਦੀ ਹੈ ਨਿੱਕੀ ਮੱਛੀ ਦਾ ਗੀਤ ਕਹਾਣੀ ਵਿੱਚ ਨਿੱਕੀ ਮੱਛੀ ਆਪਣੀਆਂ ਦੂਜੀ ਸਹੇਲੀਆਂ ਨੂੰ ਪ੍ਰੇਰ ਕੇ ਹੈਂਕੜਾਬਾਦ ਅਤੇ ਗੁਸੈਲ ਸੁਨਹਿਰੀ ਮੱਛੀ ਨੂੰ ਸਬਕ ਸਿਖਾਉਂਦੀਆਂ ਹਨ ਦੱਸਦੀ ਹੈ ਕਿ ਏਕਤਾ ਕਾਮਯਾਬੀ ਦਾ ਵਡਮੁੱਲਾ ਸੂਤਰ ਹੈ ਮੰਮੀ ਦੇ ਆਖੇ ਨਾ ਲੱਗਣ ਦੀ ਪੀੜ ਵਿੱਚ ਸਿਆਣਿਆਂ ਦੀ ਗੱਲ ਮੰਨਣ ਦੇ ਹੱਕ ਵਿੱਚ ਭੁਗਤਦੀ ਹੈ ਜਦੋਂ ਕਿ ਇਸ ਸੰਗ੍ਰਹਿ ਦੀ ਆਖਰੀ ਕਹਾਣੀ ਬੱਚਿਆਂ ਨੂੰ ਸੁਪਨੇ ਲੈਣ ਦਿਓ ਉਹਨਾਂ ਮਾਪਿਆਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਇਸ ਪ੍ਰਕਾਰ ਸਮਾਜਿਕ ਭੈੜਾਂ ਦੀ ਨਿਖੇਧੀ ਅਤੇ ਚੰਗੇਰੇਪਣ ਨੂੰ ਵਡਿਆਉਣ ਵਾਲਿਆਂ ਇਹਨਾਂ ਸਮੁੱਚੀਆਂ ਕਹਾਣੀਆਂ ਵਿੱਚ ਕੋਈ ਨਾ ਕੋਈ ਸੰਦੇਸ਼ ਲੁਕਿਆ ਹੋਇਆ ਹੈ ਜੀਵ ਜੰਤੂਆਂ ਅਤੇ ਮਨੁੱਖੀ ਪਾਤਰਾਂ ਦੇ ਮਗਦੇ ਸੰਵਾਦ ਕਹਾਣੀ ਦੀ ਚਾਲ ਨੂੰ ਤੇਜ਼ੀ ਨਾਲ ਅੱਗੇ ਤੋਰਦੇ ਹਨ ਅਤੇ ਹਰ ਕਹਾਣੀ ਚਰਮ ਸੀਮਾ 'ਤੇ ਜਾ ਕੇ ਇੱਕ ਵਿਸਫੋਟਕ ਸਥਿਤੀ ਨੂੰ ਜਨਮ ਦਿੰਦੀ ਹੈ ਜਿਸ ਵਿੱਚੋਂ ਕਿਸੇ ਨਾ ਕਿਸੇ ਉਸਾਰੂ ਸਿੱਖਿਆ ਜਾਂ ਉਪਦੇਸ਼ ਦਾ ਪ੍ਰਗਟਾਵਾ ਹੁੰਦਾ ਹੈ ਇਹਨਾਂ ਬਾਲ ਕਹਾਣੀਆਂ ਦਾ ਪਲਾਟ ਗੁੰਝਲਦਾਰ ਜਾਂ ਉਲਝਾਊ ਨਹੀਂ ਸਗੋਂ ਕਿਸੇ ਇਕਹਿਰੀ ਅਤੇ ਸੰਖੇਪ ਘਟਨਾ ਨੂੰ ਦਿਲਚਸਪ ਕਹਾਣੀ ਦੀ ਰੰਗਣ ਪ੍ਰਦਾਨ ਕਰਦਾ ਹੈ ਇਉਂ ਇਹ ਕਹਾਣੀਆਂ ਬਾਲਾਂ ਲਈ ਰਾਹ ਦਸੇਰੇ ਵਜੋਂ ਸੂਚਕ ਦੀ ਜ਼ਿੰਮੇਵਾਰੀ ਨਿਭਾਉਂਦੀਆਂ ਹੋਈਆਂ ਬਾਲ ਪਾਠਕਾਂ ਦਾ ਮਨੋਰੰਜਨ ਵੀ ਕਰਦੀਆਂ ਹਨ ਅਤੇ ਭਾਸ਼ਾਈ ਗਿਆਨ ਵਿੱਚ ਵਾਧਾ ਵੀ ਢੁੱਕਵੇਂ ਚਿੱਤਰ ਵੀ ਬਾਲ ਮਨ ਨੂੰ ਭਾਉਂਦੇ ਹਨ ਅਜਿਹੀਆਂ ਕਹਾਣੀਆਂ ਦੀ ਅਜੋਕੀ ਸਮੇਂ ਵਿੱਚ ਵਿਸ਼ੇਸ਼ ਅਹਿਮੀਅਤ ਹੈ ਧੰਨਵਾਦ